ਸਤਿ ਸ਼੍ਰੀ ਅਕਾਲ ਬੇਟਾ ਹਾਂਜੀ ਦੱਸੋ ਕਿਵੇਂ ਆਏ ਕੰਮ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਬੇਟਾ ਜੀ ਇਹ ਫਿਰ ਕਿੰਨੇ ਤੋਲੇ ਤੱਕ ਵੰਗਾਂ ਹੋਣੀਆਂ ਚਾਹੀਦੀਆਂ ਇੱਕ ਤੋਲੇ ਦੀ ਇੱਕ ਬਣ ਦੀ ਦੋ ਕਰਵਾਓਗੇ ਅੱਛਾ ਜੀ ਹਾਂਜੀ ਅਤੇ ਹਾਰ ਜਿਹੜਾ ਉਹ ਉਹ ਕਿੰਨੇ ਤੋਲੇ ਦਾ ਬਣਨਾ ਚਾਹੀਦਾ ਅੱਛਾ ਜੀ ਦੋ ਚਾਰ ਤੋਲੇ ਹੋ ਗਏ ਜੀ ਹਾਂਜੀ ਅਤੇ ਉਹ ਹੋਰ ਇਸ ਤੋਂ ਇਲਾਵਾ ਬੱਸ ਇਕ ਹਾਰ ਅਤੇ ਦੋ ਚੂੜੀਆਂ ਹਾਂਜੀ ਅੱਛਾ ਜੀ

ਛਾਪ ਕਿੰਨੇ ਕਿੰਨੇ ਮਾਸੇ ਦੀ ਹੋਣੀ ਚਾਹੀਦੀ ਹੈ ਜੀ ਇਕ ਛਾਪ ਅੱਛਾ ਜੀ ਤੁਹਾਡਾ ਸੋਨਾ ਤਕਰੀਬਨ ਅੱਠ ਨੌਂ ਮਾਸੇ ਹੋਣਾ ਚਾਹੀਦਾ ਸਾਰਾ ਅੱਛਾ ਜੀ ਹਾਂਜੀ ਹਾਂਜੀ ਅਤੇ ਉਹ ਬੇਟਾ ਦੂਜਾ ਸੋਨਾ ਜਿਹੜਾ ਕਿ ਕਿਹੜਾ ਬਣਵਾਉਣਾ ਤੁਸੀਂ ਦਸ ਵਾਲਾ ਕਿ ਬਾਰਾਂ ਵਾਲਾ ਬਾਰਾਂ ਵਾਲਾ ਬਣਾਓਗੇ ਉਹ ਥੋੜ੍ਹਾ ਜਿਹਾ ਬੇਟਾ ਮਹਿੰਗਾ ਹੋਏਗਾ ਫਿਰ ਬਾਰਾਂ ਵਾਲਾ ਤਾਂ ਅੱਛਾ ਜੀ ਅਤੇ ਕਿਹੜਾ ਬਣਾਉਣਾ ਤੁਸੀਂ ਕੇ ਡੀ ਐਮ ਦਾ ਅੱਛਾ ਵਧੀਆ ਕੇ ਡੀ ਐਮ ਦੀ ਸੋਨਾ ਬਹੁਤ ਵਧੀਆ ਹੁੰਦਾ ਹੁਣ ਸਾਰੇ ਲੋਕ ਇਹੀ ਬਣਵਾ ਰਹੇ ਹਾਂਜੀ ਹਾਂਜੀ ਅੱਛਾ ਜੀ ਅੱਛਾ ਸੈੱਟ ਦਿਖਾ ਦਿੰਦੇ ਹਾਂ ਬਣੇ ਪਏ ਆਪਣੇ ਕੋਲ ਤਿਆਰ ਹੀ ਹੈ ਹਾਂਜੀ ਅਤੇ ਅਤੇ ਤਿਆਰ ਹੀ ਹੈ ਇੱਕ ਆਹ ਵਾਲਾ ਏ ਇੱਕ ਕਿੱਟੀ ਸੈੱਟ ਜੀ ਆਹ ਵਾਲਾ ਅਤੇ ਇੱਕ ਆਹ ਚੂੜੀਆਂ ਜੇ ਇਹ ਗਜਰੇ ਵੀ ਹੈਗੇ ਨੇ ਆਪਣੇ ਕੋਲੇ ਹਾਂਜੀ ਜਿਹੜਾ ਆਹ ਚੀਜ਼ ਹੈ ਨਾ ਆਹ ਵਾਲੀ ਚੂੜੀ ਵਾਲੀ ਆਹ ਚੀਜ਼ ਇਹ ਤਾਂ ਬਹੁਤ ਲੋਕ ਬਣਵਾਉਂਦੇ ਨੇ ਹਾਂਜੀ ਬਾਕੀ

ਹਾਂਜੀ ਹਾਂਜੀ ਦੱਸੋ ਆਹ ਪਸੰਦ ਹੈ ਜੀ ਅਤੇ ਆਹ ਤੁਸੀਂ ਨਾਪ ਦੇ ਦਿਓ ਨਾ ਚੂੜੀਆਂ ਦਾ ਨਾਪ ਦੇ ਦਿਓ ਅੱਛਾ ਅੱਛਾ ਉਹ ਤਾਂ ਕੜੇ ਦਾ ਵੀ ਨਾਪ ਲੈ ਕੇ ਆਏ ਆ ਨਾ ਤੁਸੀਂ ਅੱਛਾ ਜੀ ਹਾਂਜੀ ਠੀਕ ਹੈ ਜੀ ਬਣ ਜਾਏਗਾ ਜੀ ਕੋਈ ਗੱਲ ਨਹੀਂ ਅੱਛਾ ਠੀਕ ਹੈ ਬਣ ਜਾ ਕੋਈ ਗੱਲ ਨਹੀਂ ਅਤੇ ਤੁਹਾਡਾ ਤਿਆਰ ਕਰ ਦੇਵਾਂਗੇ ਜਦੋਂ ਤੁਸੀਂ ਕਹੋਗੇ ਕਦੋਂ ਤੱਕ ਚਾਹੀਦਾ ਤੁਹਾਨੂੰ ਤ ਅੱਛਾ ਠੀਕ ਹੈ ਅਤੇ ਰੇਟ ਤੁਸੀਂ ਹੁਣ ਦਾ ਲਵਾਉਣਾ ਕਿ ਬਾਅਦ ਵਿੱਚ ਲੈ ਲਵਾਉਣਾ ਜਿਹੜਾ ਹੁਣ ਦਾ ਰੇਟ ਇਹ ਆ ਜੀ ਜੇ ਤੁਸੀਂ ਹੁਣ ਦਾ ਲਵਾਉਣਾ ਤਾਂ ਫਿਰ ਤੁਸੀਂ ਪੈਸੇ ਜਮਾਂ ਕਰਾ ਜਾਓ ਨਾ ਇਹ ਆ ਨਾ ਫਿਰ ਜੇ ਤੁਸੀਂ ਪੈਸੇ ਜਮਾਂ ਨਾ ਕਰਾਏ ਤਾਂ ਤੁਹਾਨੂੰ ਦੂਸਰਾ ਰੇਟ ਲੱਗੇਗਾ ਜਦੋਂ ਤੁਸੀਂ ਲੈ ਕੇ ਜਾਓਗੇ ਚੈਨੀਆਂ ਵੀ ਦੇਖ ਲਓ ਆਹ ਚੈਨੀਆਂ ਪਈਆਂ ਹੋਈਆਂ ਜਿਹੜੀਆਂ ਮਰਜ਼ੀ ਦੇਖ ਲਓ ਸਿੰਪਲ ਵੀ ਹੈ ਆਪਣੇ ਕੋਲੇ ਦੂਸਰੇ ਹਾਂਜੀ ਨਹੀਂ ਨਹੀਂ ਇਥੋਂ ਮਤਲਬ ਆਹ ਵਾਲਾ ਏ ਅਤੇ ਇੱਕ ਹੈਗਾ ਏ ਇਹ ਬੰਦਿਆਂ ਵਾਲੀਆਂ ਆਹ ਵੀ ਬਹੁਤ ਸੋਹਣੀਆਂ ਚੱਲਦੀਆਂ ਪਈਆਂ ਨੇ ਹਾਂ ਤੁਸੀਂ ਆਪਣੇ ਹਿਸਾਬ ਨਾਲ ਤਿੰਨ ਚਾਰ ਤੁਹਾਨੂੰ ਦਿਖਾ ਦਿੱਤੀਆਂ ਨੇ ਅਤੇ ਪਸੰਦ ਕਰ ਲਓ ਅਤੇ ਜਿਹੜੀ ਤੁਹਾਨੂੰ ਪਸੰਦ ਹੈ ਅਤੇ ਉਹ ਤੁਸੀਂ ਦੱਸ ਦਿਓ ਫਿਰ ਆਪਾਂ ਨੂੰ ਅੱਛਾ ਜੀ ਠੀਕ ਹੈ ਆਹ ਵਾਲੀ ਸੋਹਣੀ ਆ ਆਹ ਵਾਲੀ ਦੇਖ ਲਓ ਪਸੰਦ ਆ ਤੁਹਾਨੂੰ ਉਹ ਕੋਈ ਨਹੀਂ ਫਿਰ ਬਣਾਵਾਂਗੇ ਕੁਛ ਤਾਂ ਇਹ ਤੁਸੀਂ ਜਮ੍ਹਾਂ ਕਰ ਜਾਓ ਬੇਟਾ ਹਾਂ ਕੁਛ ਫਿਰ ਦੂਸਰੀ ਕਿਸ਼ਤ 'ਚੋਂ ਦੇ ਜਾਣਾ ਹਾਂਜੀ ਹਾਂਜੀ ਧੰਨਵਾਦ ਓਕੇ